ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਗੁਰੂ ਟਰੈਵਲ ਏਜੰਸੀ ਤੋਂ ਬੋਲ ਰਹੇ ਹਾਂਜੀ ਹਾਂਜੀ ਨਹੀਂ ਨਹੀਂ ਸੇਵਾ ਕੋਈ ਨਹੀਂ ਬਸ ਕਾਰ ਬੁੱਕ ਕਰਵਾਉਣ ਬਾਰੇ ਸੋਚ ਰਹੇ ਸੀਗੇ ਅਤੇ ਮੈਨੂੰ ਆਪਣੇ ਕਿਸੇ ਯਾਰ ਬੇਲੀ ਨੇ ਤੁਹਾਡਾ ਦਿੱਤਾ ਨੰਬਰ ਕਿ ਇੱਥੋਂ ਕਰਵਾ ਲਓ ਇਹਨਾਂ ਦੀ ਸਰਵਿਸ ਵੀ ਕਾਫ਼ੀ ਵਧੀਆ ਆ ਨਾਲ ਭਾਅ ਜੀ ਦਾ ਸੁਭਾਅ ਵੀ ਕਾਫ਼ੀ ਚੰਗਾ ਅਤੇ ਮੈਂ ਕਿਹਾ ਚੱਲੋ ਵੇਖ ਲੈਂਦੇ ਨਹੀਂ ਬਸ ਜਾਣਾ ਹੈ ਤਾਂ ਪਠਾਨਕੋਟ ਤੋਂ ਅੰਮ੍ਰਿਤਸਰ ਮੈਂ ਕਿਹਾ ਨਾਲ ਛੁੱਟੀਆਂ ਪਈਆਂ ਬੱਚਿਆਂ ਨੂੰ ਘੁੰਮ ਫਿਰ ਆਈਏ ਨਾਲ ਬਾਬੇ ਦੇ ਮੱਥਾ ਟੇਕ ਆਈਏ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੋਹਨ ਨੇ ਦਿੱਤਾ ਸੀਗਾ ਮੈਨੂੰ ਤੁਹਾਡਾ ਨੰਬਰ ਆ ਹਾਂਜੀ ਅਤੇ ਦੱਸ ਰਹੇ ਤੁਹਾਡੇ ਬਾਰੇ ਕਹਿੰਦਾ ਕਾਫ਼ੀ ਚੰਗਾ ਸੁਭਾਅ ਹੈ ਭਾਅ ਜੀ ਦਾ ਹਾਂਜੀ ਅਤੇ ਕੀ ਕਿਰਾਇਆ ਪੈ ਜਾਊ ਭਲਾ ਆਪਾਂ ਨੂੰ ਨਹੀਂ ਨਹੀਂ ਭਾਅ ਜੀ ਪੈਂਤੀ ਸੌ ਤਾਂ ਕਾਫ਼ੀ ਜ਼ਿਆਦਾ ਨਹੀਂ ਨਹੀਂ ਨਹੀਂ ਨਹੀਂ ਨਹੀਂ ਮੈਨੂੰ ਮੋਹਨ ਨੇ ਕਿਹਾ ਸੀਗਾ ਵੀ ਰੇਟ ਵਗੈਰਾ ਜਾਇਜ਼ ਲਗਾਉਂਦੇ ਹੈ ਅਤੇ ਮੈਂ ਤਾਂ ਹੀ ਤੁਹਾਨੂੰ ਫ਼ੋਨ ਕੀਤਾ ਆਪਣੇ ਬੰਦੇ ਦਾ ਇਹ ਹੀ ਫ਼ਾਇਦਾ ਹੁੰਦਾ ਹਾਂਜੀ ਨਹੀਂ ਨਹੀਂ ਭਾਅ ਜੀ ਤੁਸੀਂ ਪੱਚੀ ਸੌ 'ਤੇ ਗੱਲ ਮੁਕਾਓ ਨਹੀਂ ਨਹੀਂ ਕੋਈ ਨਹੀਂ ਫਿਰ ਕੀ ਆ ਪੱਚੀ ਸੌ ਠੀਕ ਹੈ ਹਾਂਜੀ ਹਾਂਜੀ ਹਾਂਜੀ ਚੱਲੋ ਠੀਕ ਆ ਪੱਚੀ ਸੌ ਠੀਕ ਆ ਫਿਰ ਅਤੇ ਮੈਂ ਤੁਹਾਨੂੰ ਐਡਰੈੱਸ ਇੱਥੇ ਦੱਸਦਾ ਕਿ ਵਟਸਐਪ ਕਰਦਾਂ ਅੱਛਾ ਇੱਥੇ ਦੱਸਦਾਂ ਹਾਂਜੀ ਪਠਾਨਕੋਟ ਮੇਰਾ ਐਡਰੈੱਸ ਇੱਥੇ ਹਿਮਾਲਿਆ ਬੇਕਰੀ ਆ ਆਪਣੀ ਢਾਂਗੂ ਰੋਡ 'ਤੇ ਅਤੇ ਉਹਦੇ ਨਾਲ ਦੀ ਗਲੀ ਵਿੱਚ ਜਾ ਕੇ ਰਾਈਟ ਲੈ ਕੇ ਅਤੇ ਬਲੈਕ ਗੇਟ ਆ ਉੱਥੇ ਆਪਾਂ ਦਾ ਅਤੇ ਬਲੂ ਕਲਰ ਦੀ ਕੋਠੀ ਹੈ ਅਤੇ ਬਾਹਰ ਨੇਮ ਪਲੇਟ ਲਿਖੀ ਹੋਣੀ ਸ਼ਰਮਾ ਨਿਵਾਸ ਹਾਂਜੀ ਹਾਂਜੀ ਅਤੇ ਆਪਾਂ ਜਾਣਾ ਐਤਵਾਰ ਨੂੰ ਜਾਣਾ ਆਪਾਂ ਹਾਂਜੀ ਵੀਹ ਤਾਰੀਕ ਨੂੰ ਅਤੇ ਗੱਡੀ ਭੇਜ ਦਿਓ ਫਿਰ ਤੁਸੀਂ ਸਵੇਰੇ ਅੱਠ ਕੁ ਵਜੇ ਨਾਲ ਹਾਂਜੀ ਹਾਂਜੀ ਠੀਕ ਐ ਮਿਹਰਬਾਨੀ ਭਾਜੀ ਮਿਹਰਬਾਨੀ ਧੰਨਵਾਦ